ਇੱਕ ਚਿੱਤਰਕਾਰ ਨੂੰ ਚਿੱਤਰਕਾਰੀ ਕਰਨ ਲਈ ਪਹਿਲਾਂ ਤਾਂ ਉਹਨੂੰ ਬਹੁਤ ਵਧੀਆ ਢੰਗ ਨਾਲ ਨਮੂਨਾ ਤਿਆਰ ਕਰਨਾ ਚਾਹੀਦਾ ਹੈ ਜਿਵੇਂ ਕਿ ਉਸਨੂੰ ਨਮੂਨਾ ਤਿਆਰ ਕਰਨ ਲਈ ਇੱਕ ਪੇਜ ਕਲਰਸ ਪੈਨਸਲ ਵਗੈਰਾ ਆਦਿ ਚਾਹੀਦਾ ਹੈ ਅਤੇ ਉਸ ਨੂੰ ਪੇਂਟ ਕਰਨ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਹਨ ਅਤੇ ਉਸਨੂੰ ਆਪਣੇ ਹੁਨਰ ਨੂੰ ਸੁਧਾਰਨਾ ਹੋਵੇ ਤਾਂ ਇਸ ਲਈ ਉਹ ਪਹਿਲਾਂ ਪੈਨਸਲ ਨਾਲ ਆਪਣਾ ਨਮੂਨਾ ਬਣਾ ਲਵੇ ਅਤੇ ਉਸ ਵਿੱਚ ਪੇਂਟ ਕਰ ਲਵੇ ਇਸ ਢੰਗ ਨਾਲ ਉਹ ਆਪਣੀ ਚਿੱਤਰਕਾਰੀ ਬਹੁਤ ਵਧੀਆ ਢੰਗ ਨਾਲ ਕਰ ਸਕਦਾ ਹੈ